ਹੈਲੋ ਹਾਂਜੀ ਹਾਂਜੀ ਬੋਲੋ ਅੱਛਾ ਜੀ ਦੱਸੋ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ ਅੱਛਾ ਜੀ ਮਾਘੀ ਦਾ ਮੇਲਾ ਮਾਘੀ ਦਾ ਮੇਲਾ ਸਾਡੇ ਮੁਕਤਸਰ 'ਚ ਹਰ ਸਾਲ ਲੱਗਦਾ ਚਾਲੀ ਮੁਕਤਿਆਂ ਦੀ ਚਾਲੀ ਮੁਕਤਿਆਂ ਦੀ ਮੁਕਤੀ ਕਰਕੇ ਖੁਸ਼ੀ ਮਨਾਈ ਜਾਂਦੀ ਹੈ ਇਸ ਦਿਨ ਇਸ ਦਿਨ ਹਾਂਜੀ ਅਤੇ ਇਹ ਇਸ ਦਿਨ ਚਾਲੀ ਮੁਕਤਿਆਂ ਦੀ ਮੁਕਤੀ ਮਿਲੀ ਇਸ ਕਰਕੇ ਮਨਾਇਆ ਜਾਂਦਾ ਖੁਸ਼ੀ 'ਚ ਅਤੇ ਉਸ ਦਿਨ ਲੋਕ ਲੋਕ ਇਹ ਲੋਹੜੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਅਤੇ ਉਸ ਦਿਨ ਲੋਕ ਸਵੇਰੇ ਉੱਠ ਕੇ ਗੁਰਦੁਆਰੇ ਇਸ਼ਨਾਨ ਕਰਨ ਜਾਂਦੇ ਆ ਅਤੇ ਗੁਰਦੁਆਰਾ ਹੈਗਾ ਉੱਥੇ ਇਸ਼ਨਾਨ ਕਰਨ ਜਾਂਦੇ ਆ ਲੋਕ ਅਤੇ ਇਸ ਦੀ ਯਾਦ ਵਿੱਚ ਮੇਲਾ ਵੀ ਬਹੁਤ ਵਧੀਆ ਬਹੁਤ ਵੱਡਾ ਮੇਲਾ ਲੱਗਦਾ ਵੀ ਝੂਲੇ ਵਗੈਰਾ ਵੀ ਲੱਗਦੇ ਆ ਝੂਲੇ ਵੀ ਲੱਗਦੇ ਆ ਚੰਡੋਲਾ ਝੂਲਿਆ ਵਿੱਚ ਚੰਡੋਲਾਂ ਲੱਗਦੀਆਂ ਹੈਂ ਕਿਸ਼ਤੀ ਲੱਗਦੀ ਹੈ ਅਤੇ ਮੌਤ ਦਾ ਖੂਹ ਵੀ ਲੱਗਦਾ ਹੁੰਦਾ ਜਿਸ ਵਿੱਚ ਉਹ ਬੰਦੇ ਆਪਣੇ ਸਟੰਟ ਕਰਕੇ ਦਿਖਾਉਂਦੇ ਆ ਗੱਡੀਆਂ ਭਜਾਉਂਦੇ ਆ ਗੋਲ ਗੋਲ ਅਤੇ ਮੋਟਰਸਾਈਕਲ ਭਜਾਉਂਦੇ ਆ ਬਹੁਤ ਵਧੀਆ ਲੱਗਦਾ ਵੇਖਣ 'ਚ ਬਹੁਤ ਮਜ਼ਾ ਵੀ ਆਉਂਦਾ ਬਹੁਤ ਲੋਕ ਮੌਤ ਦਾ ਖੂਹ ਦੇਖਣ ਜਾਂਦੇ ਆ ਚੰਡੋਲਾਂ 'ਤੇ ਝੂਟੇ ਲੈਣ ਜਾਂਦੇ ਆ ਕਿਸ਼ਤੀ 'ਤੇ ਵੀ ਲੋਕ ਬੜੇ ਚਾਅ ਨਾਲ ਝੂਟੇ ਲੈਂਦੇ ਆ ਅਤੇ ਇਥੇ ਦੁਕਾਨਾਂ ਵੀ ਲੱਗਦੀਆਂ ਕੱਪੜਿਆਂ ਦੀ ਦੁਕਾਨਾਂ ਵੀ ਲੱਗਦੀਆਂ ਕੱਪੜੇ ਦੀਆਂ ਦੁਕਾਨਾਂ ਵੀ ਲੱਗਦੀਆਂ ਅਤੇ ਮੇਕਅਪ ਮੇਕਅਪ ਵਗੈਰਾ ਦੀ ਦੁਕਾਨਾਂ ਲੱਗਦੀਆਂ ਅਤੇ ਜਵੈਲਰੀ ਵਗੈਰਾ ਲੈਣੀ ਆ ਤਾਂ ਆਪਾਂ ਨੂੰ ਵਾਧੂ ਪ੍ਰਕਾਰ ਦੀ ਮਿਲ ਜਾਂਦੀ ਬਹੁਤ ਸੋਹਣੀ ਮਿਲਦੀ ਹੈ ਨਾਲੇ ਨਾਲੇ ਰੀਜਨੇਬਲ ਪ੍ਰਾਈਜ਼ 'ਤੇ ਮਿਲਦੀ ਆ ਜਵੈਲਰੀ ਵਗੈਰਾ ਕੋਈ ਵੀ ਚੀਜ਼ ਵੀ ਆਪਾਂ ਆਈ ਪੀ ਐਫਰਟ ਕਰ ਸਕਦੇ ਆ ਉਹਨਾਂ ਨੂੰ ਜਦੋਂ ਤੁਸੀਂ ਘੁੰਮਣ ਆਉਣਾ ਹੋਵੇ ਤਾਂ ਮੈਨੂੰ ਪਲੀਜ਼ ਜ਼ਰੂਰ ਕੰਟੈਕਟ ਕਰਿਓ ਮੈਂ ਤੁਹਾਡੀ ਮਦਦ ਕਰਾਂਗੀ ਨਾਲੇ ਤੁਹਾਨੂੰ ਘੁਮਾ ਕੇ ਲਿਆਵਾਂਗੀ ਗੁਰਦੁਆਰਾ ਵੀ ਤੁਹਾਨੂੰ ਘੁੰਮਾ ਕੇ ਲਿਆਵਾਂਗੀ ਵੀ ਜਿੱਥੇ ਲੋਕ ਇਸ਼ਨਾਨ ਕਰਨ ਜਾਂਦੇ ਆ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈਗਾ ਵੀ ਉਤੇ ਬਹੁਤ ਗਿਣਤੀ 'ਚ ਲੋਕ ਇਕੱਠੇ ਹੁੰਦੇ ਆ ਅਤੇ ਇਸ਼ਨਾਨ ਕਰਦੇ ਆ ਅਤੇ ਮੇਲੇ 'ਚ ਵੀ ਬ ਕਾਫੀ ਰੌਣਕਾਂ ਲੱਗੀਆਂ ਹੁੰਦੀਆਂ ਤੁਸੀਂ ਜ ਜ਼ਰੂਰ ਘੁੰਮਣ ਆਇਓ ਤੁਸੀਂ ਤੁਹਾਨੂੰ ਵੀ ਮਜ਼ਾ ਆਏਗਾ ਵੀ ਪਰਿਵਾਰ ਨੂੰ ਵੀ ਜ਼ਰੂਰ ਲੈ ਕੇ ਆਇਓ ਓਕੇ ਮੈਨੂੰ ਪਲੀਜ਼ ਜ਼ਰੂਰ ਕੰਟੈਕਟ ਕਰ ਲਿਓ ਓਕੇ